ਮੈਂ ਰੋਪੜ ਸ਼ਹਿਰ ਦਾ ਵਸਨੀਕ ਹਾਂ ਰੋਪੜ ਸ਼ਹਿਰ ਦਾ ਸਾਰਾ ਏਰੀਆ ਦਰੱਖ਼ਤਾਂ ਨਾਲ ਹਰਿਆ ਭਰਿਆ ਹੈ ਇਸ ਸ਼ਹਿਰ ਦੇ ਵਿੱਚ ਸਾਰੇ ਪੰਜਾਬ ਨਾਲੋਂ ਪ੍ਰਦੂਸ਼ਣ ਦੀ ਬਹੁਤ ਘੱਟ ਮਾਤਰਾ ਹੈ ਇਸ ਦੇ ਵਿੱਚ ਦਰੱਖ਼ਤ ਲਗਾਉਣ ਦੇ ਵਿੱਚ ਕਾਫ਼ੀ ਜੱਥੇਬੰਦੀਆਂ ਦਾ ਬਹੁਤ ਸਾਰਾ ਯੋਗਦਾਨ ਹੈ ਸਾਰੀਆਂ ਜੱਥੇਬੰਦੀਆਂ ਆਪਣੇ ਆਪਣੇ ਤਜ਼ਰਬੇ ਦੇ ਨਾਲ਼ ਦਰੱਖ਼ਤ ਲਗਾਉਂਦੀਆਂ ਹਨ ਮੈਂ ਵੀ ਸਮਾਜ ਸੇਵਾ ਸੇਵੀ ਜੱਥੇਬੰਦੀ ਦਾ ਮੈਂਬਰ ਹਾਂ ਅਸੀਂ ਵੀ ਸੜਕਾਂ ਦੇ ਆਲ਼ੇ ਦੁਆਲੇ ਤਰ੍ਹਾਂ ਤਰ੍ਹਾਂ ਦੇ ਰੁੱਖ ਲਗਾਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਰੁੱਖ ਲਗਾਉਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਬੱਚਿਆਂ ਨੂੰ ਰੁੱਖਾਂ ਦੀ ਦੇਖਭਾਲ ਬਾਰੇ ਵੀ ਗਿਆਨ ਹਾਸਲ ਕਰਵਾਉਂਦੇ ਹਨ ਰੁੱਖਾਂ ਦੀ ਲਗਾਈ ਦੇ ਨਾਲ ਆਕਸੀਜਨ ਦੀ ਕਮੀ ਦੇ ਨਾਲ ਅੱਗੇ ਪਿੱਛੇ ਕਾਫ਼ੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਸਾਡੇ ਇਲਾਕੇ ਦੇ ਵਿੱਚ ਪਾਪਲਰ ਅਤੇ ਸਫ਼ੈਦਾ ਅਪ੍ਰੈਲ ਮਈ ਔਰ ਜੂਨ ਮਹੀਨੇ ਦੇ ਵਿੱਚ ਖੇਤਾਂ ਵਿੱਚੋਂ ਕੱਟਿਆ ਜਾਂਦਾ ਹੈ ਉਸ ਟਾਈਮ ਖੇਤ ਸਾਰੇ ਖ਼ਾਲੀ ਹੁੰਦੇ ਹਨ ਅਤੇ ਜਦੋਂ ਦਰਖ਼ਤ ਕੱਟੇ ਜਾਂਦੇ ਹਨ ਤਾਂ ਕਿਸੇ ਫ਼ਸਲ ਦਾ ਕੋਈ ਨੁਕਸਾਨ ਇਹਨਾਂ ਮਹੀਨਿਆਂ ਵਿੱਚ ਨਹੀਂ ਹੁੰਦਾ ਲੇਕਿਨ ਇਹਨਾਂ ਦੀ ਕਮੀ ਇਹ ਹੈ ਕਿ ਇਹ ਜ਼ਮੀਨ ਦੇ ਵਿੱਚੋਂ ਪਾਣੀ ਦੀ ਮਾਤਰਾ ਨੂੰ ਬਹੁਤ ਖਿੱਚਦੇ ਹਨ ਅਤੇ ਜੋ ਇਸ ਆਦਮੀ ਇਸ ਦਰਖ਼ਤਾਂ ਨੂੰ ਲਗਾਉਂਦਾ ਹੈ ਉਹਨਾਂ ਨੂੰ ਮੁਨਾਫ਼ਾ ਵੀ ਕਾਫੀ ਹੁੰਦਾ ਹੈ ਲੇਕਿਨ ਕਮੀ ਇਹ ਹੀ ਹੈ ਕਿ ਇਹ ਜ਼ਮੀਨ ਵਿੱਚੋਂ ਪਾਣੀ ਦੀ ਮਾਤਰਾ ਜ਼ਿਆਦਾ ਖਿੱਚਦੇ ਹਨ ਅਤੇ ਆਪਣੇ ਨਜ਼ਦੀਕ ਹੋਈ ਫ਼ਸਲ ਨੂੰ ਵੀ ਥੋੜ੍ਹਾ ਨੁਕਸਾਨ ਪਹੁੰਚਾਉਂਦੇ ਹਨ